ਮੇਰੀ ਮਨਪਸੰਦ ਖੇਡ ਹਾਕੀ ਹੈ ਇਹ ਹਾਕੀ ਦੀ ਖੇਡ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਸਾਡੀ ਇੰਟਰਨੈਸ਼ਨਲ ਖੇਡ ਵੀ ਹੈ ਇਹ ਹਰ ਇੱਕ ਵਿਦਿਆਰਥੀ ਦੇ ਵਿੱਚ ਹਰ ਇੱਕ ਸਟੂਡੈਂਟ ਨੂੰ ਇੱਕ ਹੁਨਰ ਅਤੇ ਕਲਾ ਪੈਦਾ ਕਰਦੀ ਹੈ ਹਾਕੀ ਦੀ ਖੇਡ ਬਹੁਤ ਹੀ ਜ਼ਿਆਦਾ ਵਧੀਆ ਹੈ ਅਤੇ ਹਰ ਇੱਕ ਨੂੰ ਇਹ ਖੇਡ ਖੇਡਣੀ ਚਾਹੀਦੀ ਹੈ ਇਸ ਖੇਡ ਨੂੰ ਖੇਡਣ ਦੇ ਨਾਲ ਹਰ ਇੱਕ ਬੱਚੇ ਦਾ ਮਾਨਸਿਕ ਤਣਾਅ ਦੂਰ ਹੁੰਦਾ ਹੈ ਅਤੇ ਸਰੀਰ ਦਾ ਵਿਕਾਸ ਹੁੰਦਾ ਹੈ ਪੋਜ਼ਟਿਵ ਵਿਚਾਰ ਹਰ ਇੱਕ ਬੱਚੇ ਦੇ ਵਿੱਚ ਆਉਣੇ ਸਟਾਟ ਹੋ ਜਾਂਦੇ ਹਨ ਮਾਨਸਿਕ ਤਣਾਅ ਘੱਟ ਜਾਂਦਾ ਹੈ ਐਂਡ ਸਟਰੈੱਸ ਖਤਮ ਹੋ ਜਾਂਦਾ ਹੈ ਹਾਕੀ ਦੀ ਖੇਡ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਖੇਡੀ ਜਾਂਦੀ ਹੈ ਬੱਚੇ ਛੋਟੀਆਂ ਛੋਟੀਆਂ ਖੇਡਾਂ ਖੇਡ ਕੇ ਇਸ ਤੋਂ ਬਾਅਦ ਉਹ ਵੱਡੇ ਮੈਚਾਂ ਦੇ ਉੱਪਰ ਹਾਈ ਲੈਵਲ 'ਤੇ ਇਹ ਖੇਡ ਖੇਡ ਸਕਦੇ ਹਨ ਇਹ ਖੇਡ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਅਤੇ ਹਰ ਇੱਕ ਬੱਚੇ ਨੂੰ ਉਹ ਇਹ ਖੇਡ ਖੇਡਣਾ ਹੀ ਚਾਹੀਦੀ ਹੈ ਹਾਕੀ ਦੀ ਖੇਡ ਸਾਡੀ ਇੰਟਰਨੈਸ਼ਨਲ ਖੇਡ ਹੋਣ ਕਰਕੇ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ